ਅੱਜ ਕੱਲ੍ਹ ਦੇ ਪਰਿਵਾਰਾਂ ਵਿੱਚ ਇੱਦਾਂ ਦਾ ਚੱਲਦਾ ਹੈ ਕਿ ਜੋ ਆਪਣੇ ਮਾਪੇ ਜਿਹੜੇ ਹੁੰਦੇ ਹਨ ਉਹ ਬੱਚਿਆਂ ਨੂੰ ਸ਼ੁਰੂ ਤੋਂ ਹੀ ਸੇਵਿੰਗ ਕਰਨ ਦੀ ਆਦਤ ਪਾਉਂਦੇ ਹਨ ਜਿਸ ਤਰ੍ਹਾਂ ਉਹ ਉਸ ਨੂੰ ਕਿਤੋਂ ਵੀ ਪੈਸੇ ਮਿਲਦੇ ਹਨ ਉਹ ਬੁਗਣੀ ਦੇ ਵਿੱਚ ਇਕੱਠੇ ਕਰ ਕਰਕੇ ਉਹ ਪੈਸੇ ਨੂੰ ਜੋੜਦੇ ਹਨ ਅਤੇ ਜਦੋਂ ਉਹ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਹਨ ਅੱਜ ਕੱਲ੍ਹ ਲੋਕਾਂ ਨੂੰ ਸੇਵਿੰਗ ਕਰਨ ਦਾ ਕਾਫ਼ੀ ਸ਼ੌਂਕ ਪੈਦਾ ਹੋ ਜਾਂਦਾ ਹੈ ਸ਼ੇਵਿੰਗ ਅਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹਾਂ ਜਿਸ ਤਰ੍ਹਾਂ ਬੈਂਕਿੰਗ ਦੇ ਵਿੱਚ ਐਫ ਡੀ ਫਿਕਸ ਡਿਪੋਜਿਟ ਅਤੇ ਕਾਫੀ ਤਰ੍ਹਾਂ ਦੀਆਂ ਸੇਵਿੰਗਸ ਹੁੰਦੀਆਂ ਹਨ ਜਿਸ ਤਰ੍ਹਾਂ ਅਸੀਂ ਆਪਣੇ ਪੈਸੇ ਨੂੰ ਸੇਵ ਕਰ ਸਕਦੇ ਹਾਂ ਮਗਰ ਅੱਜ ਕੱਲ੍ਹ ਮਿਊਚਅਲ ਫੰਡ ਦਾ ਦੌਰ ਚਲਿਆ ਹੋਇਆ ਹੈ ਜੋ ਕਿ ਮਿਊਚਲ ਫੰਡ ਵਿੱਚ ਜੋ ਆਦਮੀ ਰਿਸਕ ਲੈਣਾ ਜਾਣਦਾ ਹੈ ਉਹ ਮਿਊਚਲ ਫੰਡ ਵਿੱਚ ਇਨਵੈਸਟਮੈਂਟ ਕਰਦਾ ਹੈ ਮਿਊਚਅਲ ਫੰਡ ਵਿੱਚ ਗਰੋਥ ਕਾਫ਼ੀ ਅੱਛੀ ਹੁੰਦੀ ਹੈ ਅਤੇ ਉਸ ਦੇ ਵਿੱਚ ਰਿਸਕ ਲੈਣ ਦਾ ਵੀ ਵਾਧਾ ਹੋਣਾ ਚਾਹੀਦਾ ਹੈ ਤਾਂ ਹੀ ਜਿਹੜਾ ਬੰਦਾ ਰਿਸਕ ਲੈਂਦਾ ਹੈ ਉਹ ਹੀ ਹੀ ਪੈਸਾ ਕਮਾ ਸਕਦਾ ਹੈ ਹੋਰ ਕਾਫ਼ੀ ਸੇਵਿੰਗਸ ਹੁੰਦੀਆਂ ਹਨ ਜਿਸ ਤਰ੍ਹਾਂ ਲਾਈਫ ਇਨਸ਼ੋਰੈਸ਼ ਲਾਈਫ ਇੰਸ਼ੋਰੈਸ਼ ਦੇ ਵਿੱਚ ਇਸ ਤਰ੍ਹਾਂ ਦੀ ਸੇਵਿੰਗ ਹੁੰਦੀ ਹੈ ਜੇ ਤੁਸੀਂ ਇਸ ਦੇ ਨਾਲ ਲਾਈਫ ਦਾ ਵੀ ਰਿਸਕ ਕਵਰ ਹੁੰਦਾ ਹੈ ਜੇ ਕੋਈ ਮਿਸ ਮਿਸਹੈਪਨਿੰਗ ਹੋ ਜਾਵੇ ਤਾਂ ਉਸਦੀ ਫੈਮਲੀ ਨੂੰ ਉਸ ਵੇਲੇ ਜਿੰਨੀ ਵੀ ਇਨਸ਼ੋਰੈਂਸ ਹੁੰਦੀ ਹੈ ਉਸ ਦਾ ਰਿਫੰਡ ਮਿਲ ਜਾਂਦਾ ਹੈ ਇਸ ਤਰ੍ਹਾਂ ਜੇ ਉਨ ਉਸ ਦੀ ਕੁਛ ਵੀ ਨਾ ਹੋਵੇ ਤਾਂ ਉਸਨੂੰ ਹੀ ਨੂੰ ਵਿਧ ਵਿਆਜ ਵੀਹ ਪੱਚੀ ਸਾਲਾਂ ਬਾਅਦ ਕਾਫ਼ੀ ਰਿਟਰਨ ਅੱਛੀ ਮਿਲ ਜਾਂਦੀ ਹੈ ਇਸ ਤਰ੍ਹਾਂ ਬੁਢਾਪਾ ਪੈਨਸ਼ਨ ਵੀ ਹੁੰਦੀਆਂ ਹਨ ਇਸ਼ੋਰੈਂਸ ਸੈਕਟਰ ਦੇ ਵਿੱਚ ਕਾਫ਼ੀ ਬੁੜਾਪਾ ਪੈਨਸ਼ਨ ਅਤੇ ਕੋਈ ਕਾਫ਼ੀ ਸਕੀਮਾਂ ਸੇਵਿੰਗ ਦੀਆਂ ਹੁੰਦੀਆਂ ਹਨ ਇਹ ਇਸ ਤਰ੍ਹਾਂ ਪੈਸੇ ਜੋੜਨ 'ਤੇ ਬੁਢਾਪੇ ਲਈ ਪੈਨਸ਼ਨ ਦੀ ਕਾਫ਼ੀ ਰਿਕੁਾਇਰਮੈਂਟ ਪੂਰੀ ਹੋ ਜਾਂਦੀ ਹੈ